ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਕਲਾਸ 'ਚ ਜੀ ਅੱਛਾ ਜੀ ਠੀਕ ਹੈ ਜੀ ਓ ਹੋ ਦੇਖੋ ਜੀ ਇਮਤਿਹਾਨਾਂ ਦਾ ਸਮਾਂ ਹੈ ਹੈ ਨਾ ਤੁਸੀਂ ਛੁੱਟੀ ਮੰਗ ਕੇ ਤਾਂ ਬੜਾ ਕੰਮ ਖਰਾਬ ਕਰ ਰਹੇ ਹੋ ਉਹ ਤਾਂ ਮੈਨੂੰ ਪਤਾ ਹੈ ਜੀ ਮੇਰਾ ਹੀ ਬੱਚਾ ਹੈ ਤੁਹਾਡਾ ਤਾਂ ਬਾਅਦ 'ਚ ਹੈ ਵੈਸੇ ਮੈਂ ਤਾਂ ਕਹਿੰਦੀ ਹਾਂ ਦੇਖੋ ਜੀ ਇਮਤਿਹਾਨਾਂ ਦਾ ਸਮਾਂ ਹੈ ਚੱਲੋ ਦੇਖ ਲੋ ਫਿਰ ਤੁਸੀਂ ਹੈ ਨਾ ਪਰ ਉਹਦਾ ਕੰਮ ਤੁਸੀਂ ਕਰਵਾ ਦਿਓ ਜ਼ਰੂਰ ਕਿਸੇ ਬੱਚੇ ਤੋਂ ਲੈ ਕੇ ਚੱਲੋ ਕੋਈ ਗੱਲ ਨਹੀਂ ਜੀ ਇਹ ਤਾਂ ਬਣਿਆ ਹੋਇਆ ਪਰ ਅੱਗੇ ਤੋਂ ਤੁਸੀਂ ਗੌਰ ਕਰਨੀ ਹੈ ਵੀ ਇਹ ਫੰਕਸ਼ਨ ਵਗੈਰਾ ਤੁਸੀਂ ਛੁੱਟੀ ਵਾਲੇ ਦਿਨ ਰੱਖਿਆ ਕਰੋ ਚੱਲੋ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ